ਜੀ ਹਾਂ ਅਸੀਂ ਬਿਜਲੀ ਦੇ ਖਤਰਿਆਂ ਤੋਂ ਜਾਣੂ ਹਾਂ ਕਿਉਂਕਿ ਮੇਰਾ ਇੱਕ ਬਹੁਤ ਖਾਸ ਦੋਸਤ ਹੀ ਜਿਸ ਨੂੰ ਬਹੁਤ ਜ਼ੋਰ ਕੇ ਬਿਜਲੀ ਦਾ ਝਟਕਾ ਲੱਗਿਆ ਸੀ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਬਿਜਲੀ ਦੇ ਬਹੁਤ ਸਾਰੇ ਨੁਕਸਾਨ ਹਨ ਜਿਵੇਂ ਕਿ ਜੇਕਰ ਅਸੀਂ ਗਿੱਲੇ ਪੈਰ ਦੀਆਂ ਗਿੱਲੇ ਹੱਥਾਂ ਨਾਲ ਨੰਗੀਆਂ ਤਾਰਾਂ ਨੂੰ ਹੱਥ ਲਾਈਏ ਤਾਂ ਸਾਨੂੰ ਬਹੁਤ ਜ਼ੋਰ ਕੇ ਕਰੰਟ ਪੈ ਸਕਦਾ ਹੈ ਜਿਸ ਨਾਲ ਸਾਡੀ ਜਾਨ ਤੱਕ ਵੀ ਜਾ ਸਕਦੀ ਹੈ ਅਤੇ ਸਾਨੂੰ ਸ਼ੂਆਂ ਦੇ ਵਿੱਚ ਉਂਗਲ ਵਗੈਰਾ ਨਹੀਂ ਦੇਣੀ ਚਾਹੀਦੀ ਅਤੇ ਬੱਚਿਆਂ ਨੂੰ ਉਸ ਤੋਂ ਦੂਰ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਹੜੀ ਵਾਲੇ ਦਿਨ ਬਹੁਤ ਲੋਕ ਪਤੰਗ ਉਡਾਉਂਦੇ ਹਨ ਅਤੇ ਕਈ ਵਾਰ ਉਹ ਪਤੰਗ ਬਿਜਲੀ ਦੀਆਂ ਤਾਰਾਂ ਨੂੰ ਫੜ ਲੈਂਦੇ ਹਨ ਜਿਸ ਨਾਲ ਵੀ ਬਹੁਤ ਜ਼ੋਰ ਕੇ ਬਿਜਲੀ ਦਾ ਕਰੰਟ ਪੈ ਸਕਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਇਸ ਲਈ ਸਾਨੂੰ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਸਾਨੂੰ ਚੱਪਲ ਪਾ ਕੇ ਹੀ ਤਾਰਾਂ ਨੂੰ ਹੱਥ ਲਾਉਣਾ ਚਾਹੀਦਾ ਹੈ ਅਤੇ ਕਦੇ ਵੀ ਗਿੱਲੇ ਹੱਥਾਂ ਨਾਲ ਤਾਰਾਂ ਨੂੰ ਨਹੀਂ ਫੜਨਾ ਚਾਹੀਦਾ ਅਤੇ ਹਮੇਸ਼ਾ ਬਿਜਲੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਧੰਨਵਾਦ